ਅਸੀਂ ਯਾਰਾਂ ਦੋਸਤਾਂ ਨਾਲ ਘੁੰਮਣਾ ਪਸੰਦ ਕਰਦੇ ਹਾਂ ਜਦੋਂ ਕਈ ਸਾਲਾਂ ਬਾਦ ਯਾਰ ਦੋਸਤ ਆਉਂਦੇ ਹਾਂ ਤਾਂ ਮਿਲਦੇ ਹਾਂ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਕੀ ਕਿ ਇੰਨੀ ਖੁਸ਼ੀ ਹੁੰਦੀ ਹੈ ਜਿੰਨੀ ਸਾਨੂੰ ਘਰ ਵਿੱਚ ਵੀ ਨਹੀਂ ਹੁੰਦੀ ਯਾਰਾਂ ਦੋਸਤਾਂ ਦੇ ਆਏ ਨਾਲ ਸਾਨੂੰ ਇੰਨੀ ਖੁਸ਼ੀ ਮਿਲਦੀ ਹੈ ਇਸ ਕਰਕੇ ਅਸੀਂ ਯਾਰਾਂ ਦੋਸਤਾਂ ਨਾਲ ਬਾਹਰ ਘੁੰਮਣ ਜਾਂਦੇ ਹਾਂ ਯਾਰ ਬਹੁਤ ਟੈਮ ਬਾਅਦ ਹੀ ਇਕੱਠੇ ਹੁੰਦੇ ਹਾਂ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਅਸੀਂ ਦੱਸ ਨਹੀਂ ਸਕਦੇ ਇਸ ਕਰਕੇ ਅਸੀਂ ਫੇਰ ਬਾਹਰ ਘੁੰਮਣ ਜਾਂਦੇ ਹਾਂ ਉੱਥੇ ਸ਼ੋਪਿੰਗ ਸੁਪਿੰਗ ਕਰਦੇ ਹਾਂ ਯਾਰ ਖੁਸ਼ ਰਹਿੰਦੇ ਨੇ ਅਸੀਂ ਵੀ ਖੁਸ਼ ਰਹਿੰਦੇ ਯਾਰ ਤੋਂ ਆਇਆਂ ਤੋਂ ਬਾਅਦ ਜਦੋਂ ਇਕੱਠੇ ਹੁੰਦੇ ਹਾਂ ਤਾਂ ਅਸੀਂ ਕਿਤੇ ਹੋਰ ਥਾਵਾਂ 'ਤੇ ਵੀ ਜਾਂਦੇ ਹਾਂ ਜਿਵੇਂ ਚਿੜੀਆ ਘਰ ਮੋਲ ਐਵੇਂ ਬਥੇਰੀ ਚੀਜ਼ਾਂ 'ਤੇ ਅਸੀਂ ਯਾਰਾਂ ਨਾਲ ਘੁੰਮਣ ਜਾਂਦੇ ਹਾਂ